ਸਤਿ ਸ਼੍ਰੀ ਅਕਾਲ ਜੀ ਜੀ ਹਾਂ ਸਾਨੂੰ ਵਕੀਲਾਂ ਤੋਂ ਕਾਫੀ ਪਰੇਸ਼ਾਨੀ ਹੈ ਕਿਉਂਕਿ ਜਦੋਂ ਵੀ ਅਸੀਂ ਕਿਸੇ ਵੀ ਕਾਰਨ ਕਰਕੇ ਵਕੀਲਾਂ ਦੇ ਵੱਸ ਪੈਂਦੇ ਹਾਂ ਤਾਂ ਸਾਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਤਰ੍ਹਾਂ ਇੱਕ ਤਾਂ ਵਕੀਲ ਪੈਸਾ ਬਹੁਤ ਜ਼ਿਆਦਾ ਮੰਗਦੇ ਹਨ ਜੋ ਉਹਨਾਂ ਦੀ ਫੀਸ ਹੁੰਦੀ ਹੈ ਇਹਨਾਂ ਦੀ ਫੀਸ ਬਹੁਤ ਹੀ ਜ਼ਿਆਦਾ ਹੁੰਦੀ ਹੈ ਇਸ ਨੂੰ ਕਿਸੇ ਤਰ੍ਹਾਂ ਕਿਸੇ ਤਰੀਕੇ ਨਾਲ ਕੋਈ ਕਾਨੂੰਨ ਬਣਾ ਕੇ ਇਸ ਨੂੰ ਕੰਟਰੋਲ ਵਿੱਚ ਕੀਤਾ ਜਾਵੇ ਦੂਜਾ ਪੰਜਾਬ ਪੁਲੀਸ ਜਾਂ ਕਿਸੇ ਵੀ ਪੁਲੀਸ ਦੇ ਕਿੰਨੀ ਵਾਰ ਸਾਡਾ ਕੋਈ ਵਾਹ ਵਾਸਤਾ ਪਿਆ ਹੈ ਤਾਂ ਜੇਕਰ ਕੋਈ ਇਹਨਾਂ ਤੱਕ ਕੰਮ ਪੈ ਜਾਵੇ ਜਾਂ ਜਾਂ ਕੋਈ ਬੱਤੀ ਕਰੋਸ ਹੋ ਜਾਵੇ ਜਾਂ ਕੋਈ ਹੋਰ ਕੋਈ ਘਰੇਲੂ ਝਗੜਾ ਹੋ ਜਾਵੇ ਤਾਂ ਅਸੀਂ ਸਿਰਫ ਰਿਸ਼ਵਤ ਦੇ ਕੇ ਹੀ ਇਹਨਾਂ ਤੋਂ ਖਹਿੜਾ ਛਡਾਉਂਦੇ ਹਾਂ ਸਭ ਤੋਂ ਪਹਿਲਾ ਸਟੈਪ ਇਹਨਾਂ ਦਾ ਰਿਸ਼ਵਤ ਹੁੰਦਾ ਹੈ ਬੇਸ਼ੱਕ ਗੌਰਮੈਂਟ ਮੌਜੂਦਾ ਸਰਕਾਰਾਂ ਇਹ ਵਾਅਦਾ ਕਰਦੀਆਂ ਹੋਣ ਕਿ ਅਸੀਂ ਸਟੇਟ ਨੂੰ ਰਿਸ਼ਵਤ ਖੋਰੀ ਦੀ ਜੰਜੀਰ ਤੋਂ ਮੁਕਤ ਕਰਵਾ ਲਿਆ ਹੈ ਪਰ ਇਹ ਕਹਿਣਾ ਗਲਤ ਹੋਵੇਗਾ ਕਿਉਂਕਿ ਜੋ ਜਦੋਂ ਇਹਨਾਂ ਦੇ ਧੱਕੇ ਚੜ੍ਹਦਾ ਜਾਂ ਇਹਨਾਂ ਦੇ ਵੱਸ ਪੈਂਦਾ ਹੈ ਤਾਂ ਉਸਦਾ ਸਾਰਾ ਕੰਮ ਬਿਨਾਂ ਪੈਸਿਆਂ ਤੋਂ ਨਹੀਂ ਹੁੰਦਾ ਪਿੰਡਾਂ ਵਿੱਚ ਪੰਚਾਇਤਾਂ ਵੀ ਆਪਣਾ ਕੰਮ ਇਮਾਨਦਾਰੀ ਦੇ ਨਾਲ ਨਹੀਂ ਕਰਦੀਆਂ ਕਿਉਂਕਿ ਜੋ ਵੀ ਪੈਸਾ ਸਰਕਾਰ ਵੱਲੋਂ ਪੰਚਾਇਤਾਂ ਰਾਹੀਂ ਨਗਰਾਂ ਪਿੰਡਾਂ ਨੂੰ ਦਿੱਤਾ ਜਾਂਦਾ ਹੈ ਉਹ ਸਹੀ ਤਰੀਕੇ ਦੇ ਨਾਲ ਪਿੰਡਾਂ ਵਿੱਚ ਨਹੀਂ ਲਗਾਇਆ ਜਾਂਦਾ ਸਿਰਫ ਗਲੀਆਂ ਅਤੇ ਨਾਲੀਆਂ 'ਤੇ ਉਹ ਵੀ ਜਦੋਂ ਬਿਲਕੁਲ ਪੰਚਾਇਤ ਦੇ ਸਾਢੇ ਚਾਰ ਸਾਲ ਪੂਰੇ ਹੋ ਜਾਂਦੇ ਹਨ ਚੋਣ ਜਾਬਤਾ ਲੱਗਣ ਵਾਲਾ ਹੁੰਦਾ ਹੈ ਤਾਂ ਉਦੋਂ ਜਾ ਕੇ ਇਹ ਪੰਚਾਇਤਾਂ ਆਪਣਾ ਕੰਮ ਸ਼ੁਰੂ ਕਰਦੀਆਂ ਹਨ ਨੰਬਰ ਤਿੰਨ 'ਤੇ ਪੁੱਛੇ ਗਏ ਸਵਾਲ ਮੁਤਾਬਕ ਭ੍ਰਿਸ਼ਟਾਚਾਰ ਦਾ ਅਨੁਭਵ ਹੈ ਜੇਕਰ ਤੁਸੀਂ ਕਿਸੇ ਵੀ ਕਾਰਨ ਕਰਕੇ ਜਾਂ ਕਿਸੇ ਰਜਿਸਟਰੀ ਕਰਕੇ ਤਹਿਸੀਲ ਵਿੱਚ ਤੁਸੀਂ ਜਾਣਾ ਹੋਵੇ ਜਾਂ ਇੰਤਕਾਲ ਕਰਵਾਉਣਾ ਹੋਵੇ ਤੁਹਾਨੂੰ ਜੋ ਸਰਕਾਰੀ ਫੀਸ ਹੈ ਉਹ ਤਾਂ ਦੇਣੀ ਹੀ ਪਵੇਗੀ ਕਿਉਂਕਿ ਉਹ ਤਾਂ ਦੇਣੀ ਹੀ ਹੈ ਇਸ ਤੋਂ ਇਲਾਵਾ ਜੇਕਰ ਦੇਖਿਆ ਜਾਵੇ ਜ਼ਿਆਦਾਤਰ ਤਾਂ ਰਿਸ਼ਵਤ ਖੋਰੀ ਇਹ ਮਹਿਕਮਿਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਅਤੇ ਇਹਨਾਂ ਵਿੱਚੋਂ ਕਿਸੇ ਵੀ ਦਫਤਰ ਵਿੱਚ ਚਲੇ ਜਾਉ ਤੁਹਾਨੂੰ ਬਹੁਤ ਹੀ ਮੁਸ਼ਕਿਲਾਂ ਆਉਂਦੀਆਂ ਹਨ ਅਤੇ ਜੇਕਰ ਕਿਹਾ ਜਾਵੇ ਵੀ ਭ੍ਰਿਸ਼ਟ ਮੁਕਤ ਜਾਂ ਭ੍ਰਿਸ਼ਟਾਚਾਰ ਦਾ ਅਨੁਭਵ ਬਾਰੇ ਪੁੱਛਿਆ ਗਿਆ ਹੈ ਤੁਸੀਂ ਪੁੱਛਿਆ ਹੈ ਕਿ ਤੁਸੀਂ ਭ੍ਰਿਸ਼ਟਾਚਾਰ ਦਾ ਅਨੁਭਵ ਕੀਤਾ ਹੈ ਜੀ ਹਾਂ ਮੈਂ ਭ੍ਰਿਸ਼ਟਾਚਾਰ ਅਨੁਭਵ ਕੀਤਾ ਹੈ ਮੇਰੇ ਨਾਲ ਬਹੁਤ ਵਾਰ ਸਰਕਾਰੀ ਦਫਤਰਾਂ ਵਿੱਚ ਇੱਦਾਂ ਹੋਇਆ ਹੈ ਅਤੇ ਮੈਂ ਕਿਸੇ ਦਫਤਰ ਦਾ ਨਾਮ ਨਹੀਂ ਲੈ ਸਕਦਾ ਮੈਂ ਆਪਣਾ ਕੰਮ ਹਰੇਕ ਕੰਮ ਨੂੰ ਰਿਸ਼ਵਤ ਮੰਗੀ ਜਾਂਦੀ ਹੈ ਮੇਰਾ ਅਨੁਭਵ ਇਹ ਹੈ